ਮੈਨੂੰ ਬਚਪਨ ਤੋਂ ਹੀ ਆਰਟ ਐਂਡ ਕ੍ਰਾਫਟ ਦਾ ਬਹੁਤ ਸ਼ੌਂਕ ਆ ਜਦੋਂ ਮੈਂ ਸਕੂਲ ਦੇ ਵਿੱਚ ਹੁੰਦੀ ਉਹਦੇ ਤੋਂ ਸ਼ੁਰੂ ਤੋਂ ਹੀ ਲੈਂਡਸਕੇਪ ਵਗੈਰਾ ਸੋਹਣੀਆਂ ਸੋਹਣੀਆਂ ਡਰਾਇੰਗਸ ਬਣਾਉਣਾ ਸਿੱਖਦੀ ਆ ਰਹੀ ਹਾਂ ਅਤੇ ਅੱਜ ਦੇ ਸਮੇਂ ਦੇ ਵਿੱਚ ਮੈਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਡਿਜ਼ਾਇਨਸ ਆਰਟ ਐਂਡ ਕਰਾਫਟ ਬਣਾਉਂਦੀ ਹਾਂ ਲੈਂਡਸਕੇਪਸ ਬਣਾਉਂਦੀ ਹਾਂ ਲੋਕਾਂ ਦੇ ਪੋਰਟਰੇਟ ਬਣਾਉਂਦੀ ਹਾਂ ਜੋ ਕਿ ਮੈਂ ਸੇਲ ਵੀ ਕਰਦੀ ਹਾਂ ਡਿਫਰੈਂਟ ਡਿਫਰੈਂਟ ਮੇਰੀਆਂ ਜਿਹੜੀਆਂ ਆਰਟ ਐਂਡ ਕਰਾਫਟ ਲੈਂਡਸਕੇਪ ਆ ਉਹ ਸਭ ਨੂੰ ਬਹੁਤ ਪਸੰਦ ਆਉਂਦੀਆ ਵਾ ਜੋ ਕਿ ਇੱਕ ਮੈਂ ਅੱਜ ਕੱਲ੍ਹ ਇੱਕ ਕਲਾ ਨੂੰ ਆਪਣਾ ਬਿਜਨਸ ਬਣਾ ਚੁੱਕੀ ਹਾਂ ਇਹ ਜਿਹੜੀ ਕਲਾ ਆ ਗੋਡ ਗਿਫਟਿਡ ਹੈਗੀ ਆ ਹਰ ਇੱਕ ਇਨਸਾਨ ਦੇ ਵਿੱਚ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਕਲਾ ਹੁੰਦੀਆਂ ਜੋ ਕਿ ਗੋਡ ਗਿਫਟਿਡ ਹੁੰਦੀ ਆ ਅਤੇ ਮੇਰੇ ਵਿੱਚ ਇਹ ਆਰਟ ਐਂਡ ਕਰਾਫਟ ਕਲਾ ਆ ਜਿਹਨੂੰ ਕਿ ਮੈਂ ਯੂਜ ਕਰਕੇ ਆਪਣੇ ਪੈਸੇ ਕਮਾਉਂਦੀ ਹਾਂ ਆਪਣਾ ਪੂਰੇ ਦਿਨ ਦਾ ਕੰਮ ਕੱਢਦੀ ਹਾਂ ਇਹ ਜਿਹੜੀ ਮੇਰੀ ਕ੍ਰਾਫ ਆਰਟ ਐਂਡ ਕਰਾਫਟ ਆ ਇਹਨੂੰ ਮੈਂ ਸੇਲ ਵੀ ਕਰਦੀ ਹਾਂ ਬਹੁਤ ਵਧੀਆ ਪ੍ਰਾਈਜਿਸ 'ਤੇ ਮੈਂ ਇਹਨੂੰ ਸੇਲ ਕਰ ਦਿੰਦੀ ਹਾਂ ਜਿਹਦੇ ਨਾਲ ਕਿ ਜਿਹੜਾ ਮੇਰਾ ਰੋਜ਼ ਦਾ ਗੁਜ਼ਾਰਾ ਉਹ ਹੋ ਜਾਂਦਾ ਵਾ ਇਸ ਅਤੇ ਜਿਹੜੀ ਮੇਰੀ ਕਰਸਿਵ ਰਾਈਟਿੰਗ ਆ ਉਹ ਵੀ ਬਹੁਤ ਸੋਹਣੇ ਤਰੀਕੇ ਨਾਲ ਮੈਂ ਕਰ ਲੈਂਦੀ ਹਾਂ ਜੋ ਕਿ ਹਰ ਇੱਕ ਇਨਸਾਨ ਨੂੰ ਪਸੰਦ ਆ ਜਾਂਦੀ ਆ